ਹੈਲੋ

ਸਤਿ ਸ਼੍ਰੀ ਅਕਾਲ ਮੈਡਮ ਜੀ

ਤਿੰਨ ਪਾਠਾਂ ਦਾ ਕੰਮ ਮੈਡਮ ਜ਼ਿਆਦਾ ਨਾ ਹੋ ਜੇ ਬੱਚਿਆਂ ਲਈ ਯਾਦ ਕਰਨਾ ਉਹਨੂੰ ਸਮਝਣ ਵਿਚ ਮੁਸ਼ਕਿਲ ਆ ਸਕਦੀ ਹੈ ਠੀਕ ਹੈ ਮੈਡਮ ਜੀ ਚਲੋ ਕਰਾ ਦਿਓ ਸਤਿ ਸ਼੍ਰੀ ਅਕਾਲ